ਸਰ ਸਤਿ ਸ਼੍ਰੀ ਅਕਾਲ ਜੀ ਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੋਲਦੇ ਹੋ ਸਰ ਮੈਂ ਮਾਨ ਬੋਲ ਰਿਹਾ ਜੀ ਇੱਥੇ ਬਡੂੰਗਰ ਤੋਂ ਅਤੇ ਮੈਂ ਨਾ ਐਡਮਿਸ਼ਨ ਲੈਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਅਤੇ ਮੈਂ ਪਲੱਸ ਟੂ ਪਾਸ ਕਰੀ ਆ ਅਤੇ ਮੈਨੂੰ ਤੁਸੀਂ ਦੱਸ ਸਕਦੇ ਹੋ ਵੀ ਕਿਹੜੇ ਕਿਹੜੇ ਕੋਰਸ ਨੇ ਆਪਣੇ ਕੋਲ ਉੱਥੇ ਹੈ ਨਾ ਜੀ ਸਰ ਮੈਂ ਰਿਲੀਜ਼ਨ ਸਿਸ਼ੋਲੀਜੀ ਹਿਸਟਰੀ ਸਰ ਇਹ ਥੋੜ੍ਹਾ ਜਿਹਾ ਮੈਨੂੰ ਸਮਝਾ ਦਿਉ ਤੁਸੀਂ ਵੀ ਕਿਵੇਂ ਆ

ਅੱਛਾ ਜੀ ਸਰ

ਹਾਂਜੀ ਸਰ

ਹਾਂਜੀ ਹਾਂਜੀ ਸਰ

ਅੱਛਾ ਜੀ

ਅੱਛਾ ਸਾਰਾ ਕੁਝ ਵਿੱਚ ਹੀ ਹੋ ਜੂਗਾ ਹੈ ਨਾ ਜੀ

ਫਿਰ ਤਾਂ ਇਹ 'ਚ ਜੀ ਫਾਇਦਾ ਨਹੀਂ ਆਪਾਂ ਨੂੰ ਅਤੇ ਫਿਰ ਤਾਂ ਮੈਂ

ਚਲੋ ਸਰ ਮੈਂ ਕੱਲ੍ਹ ਆਉਂਦਾ ਜੀ ਜ਼ਰੂਰ ਹੈ ਨਾ ਮੈਂ ਆ ਕੇ ਜਾਂਦਾ ਮੈਂ ਤੁਹਾਨੂੰ ਮਿਲਦਾ ਫਿਰ ਜੀ ਜੀ ਸਰ ਥੈਂਕ ਯੂ ਸਰ ਥੈਂਕ ਯੂ ਸੋ ਮਚ ਜੀ